ਵਿੱਚ ਕਾਰੋਬਾਰਾਂ ਲਈ ਫੰਡਿੰਗ ਅਤੇ ਨਿਵੇਸ਼ ਦੇ ਮੁੱਖ ਸਰੋਤ ਸਰਕਾਰਾਂ ਵੱਲੋਂ ਘੱਟ ਵਿਆਜ ਦਰ 'ਤੇ ਦਿੱਤਾ ਗਿਆ ਪੈਸਾ ਹੈ ਅਤੇ ਪ੍ਰਾਈਵੇਟ ਬੈਂਕਾਂ ਵੱਲੋਂ ਦਿੱਤੇ ਗਏ ਲੋਨ ਹਨ